ਅਜੋਕੇ ਸਮੇਂ ਵਿੱਚ ਤਕਨੋਲੋਜੀ ਨੇ ਬਹੁਤ ਹੀ ਤਰੱਕੀ ਕੀਤੀ ਹੈ ਜਿਸ ਦਾ ਪ੍ਰਭਾਵ ਬਹੁਤ ਸਾਰੇ ਖੇਤਰ ਜਿਵੇਂ ਖੇਤੀਬਾੜੀ ਮੱਛੀ ਪਾਲਣ ਪਸ਼ੂ ਪਾਲਣ ਡੇਰੀ ਉਤਪਾਦਨ ਅਜਿਹੇ ਖੇਤਰਾਂ ਉੱਤੇ ਪਿਆ ਹੈ ਅਤੇ ਬਹੁਤ ਸਾਰੇ ਜਿਹੜੇ ਤਕਨੀਕੀ ਕਾਢਾਂ ਨੇ ਖੇਤੀਬਾੜੀ ਜਿਹੇ ਔਖੇ ਕਿੱਤੇ ਨੂੰ ਬਹੁਤ ਹੀ ਆਸਾਨ ਕਰ ਦਿੱਤਾ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਟਰੈਕਟਰ ਕੰਬਾਈਨਾਂ ਅਤੇ ਹੋਰ ਕਈ ਅ ਮਸ਼ੀਨਾਂ ਨੇ ਖੇਤੀਬਾੜੀ ਨੂੰ ਇੱਕ ਆਸਾਨ ਕਿੱਤਾ ਬਣਾਇਆ ਹੈ ਹਾਲਾਂਕਿ ਖੇਤੀਬਾੜੀ ਇੱਕ ਬਹੁਤ ਮੁਸ਼ਕਿਲ ਕਿੱਤਾ ਹੈ ਫਿਰ ਵੀ ਇਹ ਟਰੈਕਟਰ ਕੰਬਾਈਨਾਂ ਆਦਿ ਮਸ਼ੀਨਾਂ ਨਾਲ ਇਸ ਵਿੱਚ ਬਹੁਤ ਮਦਦ ਮਿਲਦੀ ਹੈ ਹੁਣ ਮੱਛੀ ਪਾਲਣ ਵੀ ਵਿੱਚ ਵੀ ਕਈ ਸਾਰੀਆਂ ਕਾਢਾਂ ਨਾਲ ਬਹੁਤ ਮਦਦ ਮਿਲੀ ਹੈ ਪਸ਼ੂ ਪਾਲਣ ਅਤੇ ਡੇਰੀ ਉਤਪਾਦਨ ਜਿਹੇ ਕਿੱਤੇ ਵਿੱਚ ਵੀ ਕਈ ਸਾਰੀਆਂ ਮਸ਼ੀਨਾਂ ਅਤੇ ਕਾਢਾਂ ਨਾਲ ਬਹੁਤ ਆਸਾਨੀ ਹੋਈ ਹੈ